ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਠੀਕ ਹੈ ਜੀ ਦੱਸੋ ਜੀ ਦੱਸੋ ਬਿਲਕੁਲ ਜਾਣਕਾਰੀ ਮਿਲੂਗੀ ਹਾਂਜੀ ਤੁਸੀਂ ਮਾਨਸਾ 'ਚ ਵਿੱਦਿਅਕ ਅਦਕਾਰੇ ਦੀ ਵਿੱਦਿਅਕ ਅਦਾਰੇ ਦੀ ਗੱਲ ਕਰਦੇ ਹੋ ਤਾਂ ਆਪਣਾ ਸਭ ਤੋਂ ਪਹਿਲਾਂ ਜਿਹੜਾ ਕਿ ਫੇਮਸ ਨਾਮ ਆਉਂਦਾ ਜੀ ਦੇਖੋ ਉਹ ਆਉਂਦਾ ਹੈਗਾ ਨਹਿਰੂ ਕੋਲਜ ਦਾ ਨਹਿਰੂ ਮਮੋਰੀਅਲ ਕੋਲਜ ਜਿੱਥੇ ਇਹ ਸਰਕਾਰੀ ਕੋਲਜ ਹੈ ਜਿੱਥੇ ਕਿ ਤੁਸੀਂ ਆਰਟਸ ਦੀ ਸਟੱਡੀ ਕਰ ਸਕਦੇ ਹੋ ਆਰਟਸ ਅਤੇ ਕਮਰਸ ਹਾਂਜੀ ਇਹ ਬਹੁਤ ਵਧੀਆ ਕੋਲਜ ਆ ਬਹੁਤ ਵਧੀਆ ਸਟਾਫ ਹੈ ਹਾਂ ਘੁੰਮਣ ਦੇ ਲਈ ਤੁਸੀਂ ਮਤਲਬ ਸਭ ਤੋਂ ਵਧੀਆ ਜੋ ਜਗ੍ਹਾ ਉੱਥੇ ਸੈਂਟਰ ਪਾਰਕ ਦੇ ਨਾਮ ਦਾ ਇੱਕ ਪਾਰਕ ਬਣਿਆ ਹੋਇਆ ਜਦੋਂ ਕਿ ਬਹੁਤ ਵੱਡਾ ਹੈਗਾ ਦੋ ਕਿੱਲਿਆਂ ਦੇ ਲਗਭਗ ਵਿੱਚ ਉਹਦੇ ਵਿੱਚ ਘਾਹ ਲੱਗਿਆ ਹੋਇਆ ਤੁਸੀਂ ਘੁੰਮ ਸਕਦੇ ਹੋ ਐਕਸਰਸਾਈਜ ਸਕਦੇ ਹੋ ਵੋਕ ਕਰ ਸਕਦੇ ਹੋ ਹਾਂ ਉੱਥੇ ਦੋ ਗਰਾਊਂਡ ਨੇ ਬਾਸਕਿਟਬਾਲ ਦਾ ਇੱਕ ਕੋਟ ਆ ਦੋ ਕੋਟ ਬੈਡਮਿੰਟਨ ਦੇ ਨੇ ਤੁਸੀਂ ਉੱਥੇ ਗੇਮ ਵੀ ਕਰ ਸਕਦੇ ਹੋ ਆਪਣੀ ਜੀ ਬਹੁਤ ਸਾਰੇ ਦਰੱਖਤ ਆ ਗਰੀਨਰੀ ਬਹੁਤ ਸੋਹਣੀ ਲੱਗੀ ਹੋਈ ਆ ਹਾਂਜੀ ਕੰਕਰੀਟ ਕੋਰਟ ਨੇਗੇ ਕੰਕਰੀਟ ਕੋਰਟ ਨੇਗੇ ਪਰ ਉੱਥੇ ਗੇਮ ਲੱਗਦੀ ਹੈ ਸ਼ਾਮ ਨੂੰ ਬੱਚੇ ਵੀ ਆਉਂਦੇ ਆ ਅਤੇ ਵਧੀਆ ਜੰਗ ਏਜ ਦੇ ਮੁੰਡੇ ਵੀ ਆਉਂਦੇ ਆ ਬਹੁਤ ਵਧੀਆ ਗੇਮ ਲੱਗਦੀ ਹੈ ਮਾਹੌਲ ਵੀ ਵਧੀਆ ਹੁੰਦਾ ਸਰਕਾਰ ਵੱਲੋਂ ਸਹੂਲਤ ਇਹ ਹੈ ਵੀ ਉੱਥੇ ਪਾਣੀ ਆਰ ਓ ਫਿਲਟਰ ਪਾਣੀ ਮਿਲਦਾ ਰਾਤ ਨੂੰ ਗੇਮ ਵਾਸਤੇ ਲਾਈਟਾਂ ਦਾ ਪ੍ਰਬੰਧ ਹੈ ਸਾਫ਼ ਸਫ਼ਾਈ ਦਾ ਪੂਰਾ ਪ੍ਰਬੰਧ ਹੈ ਅਤੇ ਪੇਟਸ ਵਗੈਰਾ ਜੋ ਕਿ ਜਾਂ ਕੋਈ ਵੀ ਐਨੀਮਲਜ਼ ਉੱਥੇ ਅੰਦਰ ਉਹਦੇ ਜਾਨਵਰ ਅਲਾਊਡ ਨਹੀਂ ਹੈਗੇ ਅੰਦਰ ਸੇਫਟੀ ਦੇ ਪੂਰੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਹਾਂਜੀ ਓਕੇ ਜੀ ਓਕੇ